ਹਾਂਜੀ ਇੱਕ ਯਾਤਰੀ ਬੱਸ ਦੇ ਵਿੱਚ ਇੱਕ ਡਰਾਈਵਰ ਸੀਟ ਹੁੰਦੀ ਹੈ ਅਤੇ ਇੱਕ ਕੰਡਕਟਰ ਸੀਟ ਹੁੰਦੀ ਹੈ ਅਤੇ ਲਗਭਗ ਤੀਹ ਤੋਂ ਚਾਲ੍ਹੀ ਯਾਤਰੀਆਂ ਲਈ ਸੀਟਾਂ ਹੁੰਦੀਆਂ ਹਨ ਜਿਨ੍ਹਾਂ ਦੇ ਉੱਪਰ ਸਟੋਰੇਜ ਕੈਰੀਅਰ ਬਣੇ ਹੁੰਦੇ ਹਨ ਜਿੱਥੇ ਕਿ ਲੋਕ ਆਪਣੇ ਆਪਣਾ ਸਮਾਨ ਰੱਖ ਸਕਦੇ ਹਨ ਅਤੇ ਇਸ ਦੀ ਡਿੱਗੀ ਦੇ ਵਿੱਚ ਵੀ ਸਮਾਨ ਰੱਖ ਸਕਦੇ ਹਨ ਅਤੇ ਯਾਤਰੀਆਂ ਲਈ ਸੀਟਾਂ ਦੀ ਹਰ ਇੱਕ ਸੀਟ ਉੱਤੇ ਲਗਭਗ ਇੱਕ ਤਾਂ ਵਿੰਡੋ ਸੀਟ ਹੁੰਦੀ ਹੈ ਅਤੇ ਜ਼ਿਆਦਾਤਰ ਯਾਤਰੀ ਇਸ ਸੀਟ ਉੱਤੇ ਬੈਠਣਾ ਪਸੰਦ ਕਰਦੇ ਹਨ ਤਾਂ ਕਿ ਉਹ ਬਾਹਰ ਵਾਲੀ ਬਾਹਰ ਵਾਲੇ ਦੇਸ਼ਾਂ ਦਾ ਆਨੰਦ ਮਾਣ ਸਕਣ ਅਤੇ ਸਾਰੀਆਂ ਬੱਸਾਂ ਡੀਜ਼ਲ ਅਤੇ ਪੈਟਰੋਲ 'ਤੇ ਕੰਮ ਕਰਦੀਆਂ ਹਨ ਅਤੇ ਮੈਂ ਬੱਸ ਦੁਆਰਾ ਬਹੁਤ ਤਰ੍ਹਾਂ ਦੀਆਂ ਯਾਤਰਾਵਾਂ ਕੀਤੀਆਂ ਹਨ ਜਿਵੇਂ ਕਿ ਅੰਮ੍ਰਿਤਸਰ ਨੂੰ ਅਨੰਦਪੁਰ ਸਾਹਿਬ ਨੂੰ ਅਤੇ ਮੈਂ ਰੋਜ਼ ਆਪਣੇ ਕੋਲਜ ਵੀ ਬੱਸ ਰਾਹੀਂ ਜਾਂਦੀ ਹਾਂ ਅਤੇ ਮੈਂ ਅਤੇ ਮੇਰੇ ਦੋਸਤ ਪਿਛਲੇ ਹੀ ਸਾਲ ਅ ਆਗਰੇ ਗਏ ਸਨ ਜੋ ਕਿ ਅਸੀਂ ਬੱਸ ਦੁਆਰਾ ਹੀ ਕੀਤਾ ਹੈ ਅਤੇ ਬੱਸ ਦੁਆਰਾ ਸਫ਼ਰ ਬਹੁਤ ਹੀ ਆਰਾਮਦਾਇਕ ਹੁੰਦਾ ਹੈ